ਬਚਪਨ ਦੀ ਗੱਲ ਹੈਗੀ ਹੈ ਮੈਂ ਜਦੋਂ ਤੀਜੀ ਚੌਥੀ 'ਚ ਪੜ੍ਹਦਾ ਸੀ ਅਤੇ ਪੜ੍ਹਦੇ ਸਮੇਂ ਦੇ ਵਿੱਚ ਅਸੀਂ ਤਿੰਨ ਦੋਸਤ ਹੁੰਦੇ ਸੀ ਮੈਂ ਬਿੱਕਰ ਅਤੇ ਹਰਦਮ ਤਿੰਨੋ ਜਾਣੇ ਸਕੂਲ ਜਾਂਦੇ ਜਾਂਦੇ ਇੱਕ ਦਿਨ ਮਨ ਬਣ ਗਿਆ ਵੀ ਅੱਜ ਸਕੂਲ ਨਹੀਂ ਜਾਣਾ ਸਕੂਲ ਦੀ ਘੰਟੀ ਵੱਜ ਗਈ ਅਤੇ ਅਸੀਂ ਉੱਥੇ ਝਾੜੀਆਂ 'ਚ ਬੈਠੇ ਬੂੱਠੇ ਰਹੇ ਬੈਠਣ ਤੋਂ ਬਾਅਦ ਸੜਕ 'ਤੇ ਆਏ ਅਤੇ ਬਾਹਰ ਘੁੰਮਣ ਖੇਡਣ ਦੇ ਚੱਕਰ ਦੇ ਵਿੱਚ ਅਤੇ ਜਦੋਂ ਦੇਖਿਆ ਵੀ ਬੁੜੀਆਂ ਆ ਰਹੀਆਂ ਨੇ ਅਤੇ ਅਸੀਂ ਚੁੱਪ ਕਰਕੇ ਢੋਲਾਂ ਦੇ ਵਿੱਚ ਵੜ ਗਏ ਅੱਗੇ ਸੜਕਾਂ ਦੇ ਉੱਤੇ ਲੁੱਕ ਵਾਲੇ ਢੋਲ ਗੱਡੇ ਜਾਂਦੇ ਤੀ ਜਿਹੜੇ ਢੋਲ ਲੁੱਕ ਖਤਮ ਹੋ ਜਾਂਦੀ ਤੀ ਅਤੇ ਉਹ ਢੋਲ ਨੂੰ ਸੜਕ ਦੇ ਕਿਨਾਰੇ 'ਤੇ ਗੱਡ ਦਿੰਦੇ ਸੀ ਅਤੇ ਉਹਦੇ ਵਿੱਚ ਵੜ ਕੇ ਬੈਠ ਗਏ ਅਤੇ ਵਿੱਚੋਂ ਹਰਦਮ ਨੇ ਉਹਦੇ ਕਤੂਰਿਆਂ ਵਾਲੀ ਆਵਾਜ਼ ਕੱਢਣੀ ਸ਼ੁਰੂ ਕਰ ਦਿੱਤੀ ਚੂੰ ਚੂੰ ਚੂੰ ਚੂੰ ਦੇਖ ਕਹਿੰਦੀ ਬੁੜੀਆਂ ਬੋਲੀਆਂ ਦੇਖ ਨੀ ਕਹਿੰਦੀ ਕੁੱਤੀ ਕਿੱਥੇ ਸੂਈ ਹੈ ਹੈਂ ਜਦੋਂ ਦੇਖਿਆ ਬੁੱਢੀ ਨੇ ਆ ਕੇ ਮਾਈ ਨੇ ਆ ਕੇ ਦੇਖਿਆ ਤਾਂ ਉਹ ਹਰਦਮ ਸਿੰਘ ਬੋਲ ਰਿਹਾ ਸੀ ਪਰ ਜਦੋਂ ਦੇਖ ਕੇ ਉਹ ਹੱਸੀਆਂ ਬਹੁਤ ਭਾਈਆਂ ਦੀ ਉਹ ਇਹ ਤਾਂ ਪੜ੍ਹਨ ਵਾਲੇ ਜਵਾਕ ਨੇ ਦੇਖਿਆ ਸਕੂਲ ਨਹੀਂ ਗਏ ਹੈ ਇੱਥੇ ਲੁਕੇ ਬੈਠੇ ਨੇ